ਸਕੂਲ ਹਾਂਜੀ ਸਰ ਮੈਨੂੰ ਸਕੂਲ ਟਾਈਮ ਤੋਂ ਹੀ ਦੌੜ ਦਾ ਬਹੁਤ ਸ਼ੌਂਕ ਆ ਅਤੇ ਮੈਂ ਉਸ ਸਕੂਲ ਟਾਈਮ ਤੋਂ ਹੀ ਦੌੜ ਲਗਾਉਂਦਾ ਰਿਹਾ ਹਾਂ ਅਤੇ ਹੁਣ ਵੀ ਮੈਂ ਕਾਫ਼ੀ ਸਾਡੇ ਲਾਗੇ ਗਰਾਊਂਡ ਬਣੀ ਹੈ ਕਾਫ਼ੀ ਵੱਡੀ ਬਣੀ ਆ ਉਹਦੇ ਵਿੱਚ ਅਸੀਂ ਡੇਲੀ ਤਿੰਨ ਕਿਲੋਮੀਟਰ ਦੀ ਦੌੜ ਲਗਾਈਦੀ ਆ ਅਤੇ ਸਰੀਰ ਦੀ ਫਿਟਨੈਸ ਜਿਹੜੀ ਆ ਵਧੀਆ ਬਣੀ ਰਹਿੰਦੀ ਹੈ ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਵਾ ਅਸੀਂ ਕਦੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਅਸੀਂ ਕਦੇ ਮਤਲਬ ਕਿ ਮਿਸ ਨਹੀਂ ਕੀਤਾ ਹਾਂ ਇਹ ਇੰਨਾ ਹੋ ਜਾਂਦਾ ਵੀ ਗਰਮੀ ਦੇ ਵਿੱਚ ਸ਼ਾਮ ਦੇ ਟਾਈਮ ਅਸੀਂ ਦੌੜ ਜਿਹੜੀ ਆ ਥੋੜ੍ਹੀ ਜਿਹੀ ਘੱਟ ਲਾਈ ਦੀ ਆ ਅਤੇ ਸਵੇਰ ਦੇ ਟਾਈਮ ਅਸੀਂ ਉਹ ਜਿਹੜੀ ਦੌੜ ਆ ਉਹ ਪੂਰੀ ਕਰ ਲਈਦੀ ਆ ਅਤੇ ਉਹ ਪੂਰੀ ਕਰਨ ਦੇ ਨਾਲ ਦੌੜ ਪੂਰੀ ਕਰਨ ਦੇ ਨਾਲ ਸਾਡਾ ਸਰੀਰ ਜਿਹੜਾ ਵਾ ਤੰਦਰੁਸਤ ਰਹਿੰਦਾ ਵਾ ਹਾਂ ਬਰਸਾਤ ਦੇ ਮੌਸਮ ਵਿੱਚ ਇਹ ਹੁੰਦਾ ਵਾ ਵੀ ਬਰਸਾਤ ਦਾ ਮੌਸਮ ਵੇਖ ਕੇ ਅਸੀਂ ਉਸ ਹਿਸਾਬ ਨਾਲ ਜੇ ਜ਼ਿਆਦਾ ਬਾਰਿਸ਼ ਹੁੰਦੀ ਹੈ ਤਾਂ ਫਿਰ ਅਸੀਂ ਥੋੜ੍ਹਾ ਜਿਹਾ ਘੱਟ ਕਰ ਲਈਦਾ ਨਹੀਂ ਤਾਂ ਅਸੀਂ ਮੌਸਮ ਦੇ ਹਿਸਾਬ ਨਾਲ ਦੇਖ ਕੇ ਅਤੇ ਉਹ ਵੀ ਚੱਲੋ ਆਪਣੀ ਦੌੜ ਪੂਰੀ ਕਰ ਲਈਦੀ ਆ ਅਤੇ ਬਾਕੀ ਹੈ ਵੀ ਸਰੀਰ ਦੀ ਫਿਟਨੈਸ ਜਿਹੜੀ ਹੈ ਦੌੜ ਦੇ ਨਾਲ ਬਹੁਤ ਵਧੀਆ ਬਣੀ ਰਹਿੰਦੀ ਆ ਅਤੇ ਸਿਹਤ ਸੇਵਾਵਾਂ ਜਿਹੜੀਆਂ ਵਧੀਆਂ ਬਣੀਆਂ ਰਹਿੰਦੀਆਂ